ਹੈਲੋ ਹਾਂਜੀ ਪੰਜਾਬੀ ਸਾਡੀ ਮਾਂ ਬੋਲੀ ਹੈ ਇੱਕ ਬੜੀ ਮਿੱਠੀ ਬੋਲੀ ਹੈ ਪੰਜਾਬੀ ਬੜੀ ਖੁਸ਼ੀ ਹੁੰਦੀ ਹੈ ਕਿ ਸਕੂਲ ਵਿੱਚ ਪੰਜਾਬੀ ਲਾਗੂ ਕਰ ਦਿੱਤੀ ਗਈ ਹੈ ਕਿ ਪੰਜਾਬੀ ਬੱਚੇ ਸਾਡਿਆਂ ਨੂੰ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਿਆ ਜਾਇਆ ਕਰਦਾ ਬੱਚਿਆਂ ਨੂੰ ਆਪਣਾ ਪੰਜਾਬੀ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ ਪਤਾ ਚੱਲਦਾ ਕਿ ਸਾਡੀ ਮਾਤਰ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਪੰਜਾਬੀ ਹੈ ਪੰਜਾਬੀ ਦੇ ਉੱਤੇ ਕਾਰਿਆਕਰਮ ਸਕੂਲਾਂ ਵਿੱਚ ਕੀਤੇ ਜਾਂਦੇ ਹੈ ਜਿਸ ਤਰ੍ਹਾਂ ਰੰਗਲਾ ਪੰਜਾਬ ਕੀਤਾ ਜਾਂਦਾ ਹੈ ਪੰਜਾਬੀ ਮੂਵੀ ਬੱਚਿਆਂ ਨੂੰ ਦੱਸੀ ਜਾਂਦੀ ਹੈ ਪੰਜਾਬੀ ਭੰਗੜਾ ਉਹ ਭੰਗੜਾ ਕੀਤੇ ਜਾਂਦੇ ਹੈ ਗਿੱਧੇ ਕੀਤੇ ਜਾਂਦੇ ਆ ਪੰਜਾਬੀ ਨਾਟਕ ਕੀਤੇ ਜਾਂਦੇ ਹੈ ਪੰਜਾਬ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਜਾਇਆ ਕਰਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਇੱਕ ਬੜੀ ਮਿੱਠੀ ਬੋਲੀ ਹੈ ਪੰਜਾਬੀ ਜਦੋਂ ਬੋਲਦਾ ਹੈ ਇਨਸਾਨ ਤਾਂ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਕਿੰਨਾ ਕੁ ਮਿੱਠਾ ਇਨਸਾਨ ਬੋਲਿਆ ਕਰਦਾ ਪੰਜਾਬੀ ਸਾਡੀ ਮਾਂ ਬੋਲੀ ਹੈ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਸਾਡੀ ਪੰਜਾਬੀ ਨੂੰ ਪੰਜਾਬ ਵਿੱਚ ਪੰਜਾਬੀ ਬੋਲਣਾ ਔਰ ਪੰਜਾਬੀ ਸਾਡੀ ਨੂੰ ਬਹੁਤ ਇੱਕ ਮਹਾਨਤਾ ਦਿੱਤੀ ਜਾਇਆ ਕਰਦੀ ਹੈ ਦਿਲ ਨੂੰ ਇੱਕ ਖੁਸ਼ੀ ਮਿਲਦੀ ਹੈ ਪੰਜਾਬੀ ਬੋਲ ਕੇ ਪੰਜਾਬੀ ਸੁਣ ਕੇ ਪਤਾ ਲੱਗਦਾ ਹੈ ਕਿ ਵਈ ਹਾਂ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਬੋਲਣ ਨਾਲ ਪੰਜਾਬੀ ਬੱਚਿਆਂ ਨੂੰ ਦੱਸਣ ਨਾਲ ਕਿੰਨਾ ਆਉਂਦਾ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਪੰਜਾਬੀ ਸੁਣ ਕੇ ਔਰ ਪੰਜਾਬੀ ਬੋਲ ਕੇ